ਆਪਾਂ ਰੋਜ਼ ਸਵੇਰੇ ਮੈਂ ਜਦ ਸਵੇਰੇ ਉੱਠ ਕੇ ਅਖਬਾਰ ਪੜ੍ਹਨਾ ਬਹੁਤ ਪਸੰਦ ਕਰਦਾ ਹਾਂ ਅਤੇ ਅਖਬਾਰ ਦੇ ਵਿੱਚ ਸਭ ਤੋਂ ਵਧੀਆ ਜਾਂ ਖੁਸ਼ੀ ਮਿਲਦੀ ਹੈ ਕਿ ਸਾਡੇ ਦੇਸ਼ ਦੇ ਖਿਡਾਰੀ ਕਿੰਨਾ ਕੁ ਕੰਮ ਕਰ ਰਹੇ ਆ ਜਦ ਸਾਡੇ ਦੇਸ਼ ਦੇ ਓਲੰਪਿਕਸ ਦੇ ਵਿੱਚ ਮੈਡਲ ਆਉਂਦੇ ਆ ਜਾਂ ਖੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਅਤੇ ਉਹਦੇ ਰਿਗਾਰਡਿੰਗ ਪੜ੍ਹ ਕੇ ਬੜਾ ਵਧੀਆ ਲੱਗਦਾ ਆ ਅਤੇ ਦੂਜਾ ਮੈਨੂੰ ਸਭ ਤੋਂ ਵਧੀਆ ਲੱਗਦਾ ਆ ਮਨੋਰੰਜਨ ਜੋ ਮੈ ਟੀਵੀ ਪ੍ਰੋਗਰਾਮ ਦੇਖਣਾ ਬਹੁਤ ਪਸੰਦ ਕਰਦਾ ਹਾਂ ਅਤੇ ਟੀਵੀ ਪ੍ਰੋਗਰਾਮ ਦੀ ਇਨਫੋਮੇਸ਼ਨ ਅਤੇ ਕਿਹੜਾ ਸੀਰੀਅਲ ਕੋਈ ਨਵਾਂ ਆਇਆ ਹੈ ਜਾਂ ਕੋਈ ਸੀ ਸੀਰੀਅਲ ਦੀ ਕੋਈ ਇਨਫੋਮੇਸ਼ਨ ਅਤੇ ਉਹਦੇ ਨਾਲ ਨਾਲ ਹੋਰ ਵੀ ਚੀਜ਼ਾਂ ਕਾਫੀ ਆਪਾਂ ਲਾਇਕ ਕਰਦੇ ਹਾਂ ਵਪਾਰ ਦੇ ਬਾਰੇ ਵਿੱਚ ਜਿੱਦਾਂ ਸ਼ੇਅਰ ਮਾਰਕੀਟ ਦਾ ਥੋੜ੍ਹਾ ਨੌਲੇਜ ਰੱਖੀ ਪਸੰਦ ਆ ਜਿੱਦਾਂ ਸੇਅਰ ਮਾਰਕੀਟ ਦਾ ਪੜ੍ਹ ਲਈਦਾ ਆ ਵਪਾਰ ਦੇ ਵਿੱਚ ਜਿੱਦਾਂ ਗੋਲਡ ਦਾ ਪ੍ਰਾਈਸ ਕੀ ਚਲਦਾ ਪਿਆ ਉਹਦੇ 'ਚ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਸਬਜ਼ੀ ਦੇ ਭਾਅ ਕੀ ਆ ਉਹ ਪਤਾ ਲੱਗ ਜਾਂਦਾ ਆ ਕੱਪੜੇ ਦਾ ਭਾਅ ਕੀ ਹੈ ਉਹ ਚੀਜ਼ ਪਤਾ ਲੱਗ ਜਾਂਦੀ ਆ ਗਲੋਬਲੀ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਕੀ ਚੱਲਦਾ ਪਿਆ ਉਹਦੇ ਬਾਰੇ ਇਨਫੋਰਮੇਸ਼ਨ ਮਿਲ ਜਾਂਦੀ ਹੈ ਅਤੇ ਅੱਜ ਕੱਲ੍ਹ ਸਾਡਾ ਵਿਗਿਆਨ ਜਿੰਨੀ ਤਰੱਕੀ ਕਰਦਾ ਪਿਆ ਉਹਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ ਇੰਡੀਆ ਨੇ ਵਿੱਚ ਹਲੇ ਹਾਈ ਲਾਸਟ ਥੋੜ੍ਹੇ ਟਾਈਮ ਪਹਿਲਾਂ ਕਿੰਨੇ ਸਾਰੇ ਸੈਟੇਲਾਇਟ ਲਾਂਚ ਕੀਤੇ ਅਤੇ ਆਪਣੀ ਪ੍ਰੋਉਡ ਦੀ ਗੱਲ ਇੰਡੀਆ ਵਾਸਤੇ ਔਰ ਸਾਡੇ ਵਾਸਤੇ ਕਿ ਸਾਨੂੰ ਇੰਨੀ ਸਾਰੀ ਮਿਲ ਮਤਲਬ ਵਿਗਿਆਨਿਕ ਤਕੜੇ ਤਕੜੇ ਵਿਗਿਆਨੀ ਮਿਲਦੇ ਪਏ ਨੇ ਜੇ ਸਾਨੂੰ ਨਵੀਂ ਉੱਚਾਈਆਂ 'ਚ ਲੈ ਕੇ ਜਾ ਰਹੇ ਹੈ ਅੱਜ ਇਸਰੋ ਦਾ ਨਾਮ ਕਾਫੀ ਫੇਮਸ ਹੋਇਆ ਪਿਆ ਆ ਵਰਲਡ ਦੇ ਵਿੱਚ ਆਈ ਥਿੰਕ ਨਾਸਾ ਤੋਂ ਬਾਅਦ ਇਸਰੋ ਕਾਫੀ ਅੱਗੇ ਆ ਗਿਆ ਆ ਅਤੇ ਸਿੱਖਿਆ ਦੇ ਵਿੱਚ ਵੀ ਜਿੱਦਾਂ ਹੁਣ ਪੰਜਾਬ ਦੇ ਵਿੱਚ ਸਿੱਖਿਆ ਦਾ ਸਤਰ ਕਾਫੀ ਵਧੀਆ ਹੋ ਗਿਆ ਆ ਅਤੇ ਸਰਕਾਰਾਂ ਵੀ ਵਧੀਆ ਸਤਰ ਨਾਲ ਕੰਮ ਕਰਦੀਆਂ ਪਈਆਂ ਜਿੱਦਾਂ ਪ੍ਰਾਈਮਰੀ ਸਕੂਲ ਦੇ ਬੱਚਿਆਂ ਲਈ ਫਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਕਈ ਇਸ ਥਾਵਾਂ ਦੇ ਵਿੱਚ ਫਰੀ ਕਿਤਾਬਾਂ ਦਿੱਤੀ ਜਾਂਦੀ ਹੈ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਜਿਹਨਾਂ ਕਰਕੇ ਉਹ ਆਪਣਾ ਐਜੂਕੇਸ਼ਨ ਸਿਸਟਮ ਵਧੀਆ ਰੱਖਣ ਅਤੇ ਇਹ ਸਾਰੀ ਇਨਫੋਰਮੇਸ਼ਨ ਅਖਬਾਰ ਦੇ ਥਰੂ ਸਾਨੂੰ ਵਧੀਆ ਤਰੀਕੇ ਨਾਲ ਮਿਲ ਜਾਂਦੀ ਹੈ ਜਿਸ ਨੂੰ ਪੜ੍ਹ ਕੇ ਸਾਨੂੰ ਹੋਰ ਜਾਣਕਾਰੀ ਵੀ ਮਿਲ ਜਾਂਦੀ ਹੈ